ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਸਾਡੇ ਕੋਲ ਦੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਗੇਮਜ਼ ਹੁੰਦੀਆ ਨੇ ਬੱਚਿਆਂ ਵਾਸਤੇ ਇੱਕ ਆਪਾਂ ਕਰਵਾਉਂਦੇ ਹਾਂ ਇਨਡੋਰਜ਼ ਗੇਮ ਔਰ ਦੂਜੀ ਆਪਾਂ ਕਰਵਾਉਂਦੇ ਹਾਂ ਆਊਟਡੋਰ ਗੇਮ ਜਿਹੜੀ ਇਨਡੋਰ ਗੇਮਜ਼ ਹੁੰਦੀਆਂ ਨੇ ਜਿਵੇਂ ਕਿ ਬੱਚੇ ਆਪਣੇ ਹੁਣ ਤੁਹਾਨੂੰ ਪਤਾ ਕਿ ਵੈਦਰ ਜਿਹੜਾ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਬੱਚੇ ਆਊਟਡੋਰ ਗੇਮਜ਼ ਨੂੰ ਜ਼ਿਆਦਾ ਨਹੀਂ ਪਸੰਦ ਕਰਦੇ ਤਾਂ ਉਨ੍ਹਾਂ ਵਾਸਤੇ ਅਸੀਂ ਨੇ ਇਨਡੋਰ ਗੇਮਜ਼ ਰੱਖੀਆਂ ਨੇ ਜਿਵੇਂ ਕਿ ਆਪਾਂ ਚੈੱਸ ਖਿਲਵਾ ਸਕਦੇ ਹਾਂ ਲੂਡੋ ਕਰਵਾ ਸਕਦੇ ਹਾਂ ਦੈਨ ਉਸ ਤੋਂ ਬਾਅਦ ਪਜ਼ਲਜ ਕਰਵਾ ਸਕਦੇ ਹਾਂ ਇਨ੍ਹਾਂ ਨਾਲ ਕੀ ਹੁੰਦਾ ਕਿ ਬੱਚਿਆਂ ਦਾ ਨਾ ਮਾਈਂਡ ਸ਼ਾਪ ਹੁੰਦਾ ਕਿ ਇਨ੍ਹਾਂ ਚੀਜ਼ਾਂ ਨੂੰ ਸਿੱਖ ਕੇ ਬੱਚਿਆਂ ਨੂੰ ਬਰੇਨ ਐਕਟੀਵਿਟੀਜ਼ ਦਾ ਪਤਾ ਚੱਲਦਾ ਅਤੇ ਜਿਹੜੀ ਸਾਡੇ ਕੋਲ ਆਊਟਡੋਰ ਗੇਮਜ਼ ਨੇ ਉਹ ਸਾਡੀਆਂ ਫਿਜ਼ੀਕਲ ਮਤਲਬ ਕਿ ਬੋ ਫਿਟਨੈਂਸ ਦੇ ਰਿਲੇਟਡ ਆ ਜਾਂਦੀਆਂ ਨੇ ਜਿਵੇਂ ਅਸੀਂ ਨੇ ਸਟਾਰਟ ਕੀਤੀ ਏ ਹੁਣੇ ਜਸਟ ਸਕੇਟਿੰਗ ਸਟਾਰਟ ਕਰਵਾਈ ਹੈ ਅਤੇ ਨਾਲ ਹੀ ਇੱਕ ਟੈਨਿਸ ਸਟਾਰਟ ਕਰਵਾਇਆ ਅਤੇ ਇੱਕ ਇਨ੍ਹਾਂ ਨੂੰ ਬੈਡਮਿੰਟਨ ਸਟਾਰਟ ਕਰਵਾਈ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਬੱਚੇ ਜਿਹੜੇ ਉਨ੍ਹਾਂ ਦਾ ਜ਼ਿਆਦਾ ਰਨਿੰਗ ਕਰਨ ਦੇ ਵਿੱਚ ਸਟੈਮੀਨਾ ਨਹੀਂ ਹੁੰਦਾ ਤਾਂ ਇਸ ਕਰਕੇ ਉਨ੍ਹਾਂ ਵਾਸਤੇ ਅਸੀਂ ਨੇ ਇਹ ਦੋ ਤਿੰਨ ਜਿਹੜੀਆਂ ਗੇਮਜ਼ ਨੇ ਉਹ ਕਰਵਾਈਆਂ ਨੇ ਜਿਵੇਂ ਬੈਡਮਿੰਟਨ ਹੋ ਗਿਆ ਅਤੇ ਦੂਸਰੀ ਹੋ ਗਈ ਸਕੇਟਿੰਗ ਹੋ ਗਈ ਤਾਂ ਫਿਰ ਉਹਦੇ ਵਿੱਚ ਇਹ ਹੈ ਕਿ ਬੱਚੇ ਥੋੜ੍ਹਾ ਜਿਹਾ ਇੰਟਰਸਟ ਲੈ ਕੇ ਕਰਦੇ ਹੈ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਅੱਛੀ ਲੱਗਦੀਆਂ ਨੇ ਤਾਂ ਇਹ ਸਾਰੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਇਨ੍ਹਾਂ ਦੇ ਜਿਹੜੇ ਚਾਰਜਿਜ਼ ਆਪਾਂ ਲੈਂਦੇ ਹਾਂ ਉਹ ਉਨ੍ਹਾਂ ਦੀ ਗੇਮਜ਼ ਦੇ ਅਕੋਡਿੰਗ ਹੁੰਦੇ ਹੈ ਕਿਉਂਕਿ ਜਿਹੜੀ ਅਸੀਂ ਗੇਮਜ਼ ਉਨ੍ਹਾਂ ਨੂੰ ਪ੍ਰੋਵਾਈਡ ਕਰਵਾਉਂਗੇ ਉਨ੍ਹਾਂ ਦੇ ਕੋਸਟਿਉਮਸ ਵਗੈਰਾ ਜਿਵੇਂ ਉਨ੍ਹਾਂ ਦੀ ਸਪੋਟਸ ਕਿੱਟ ਹੁੰਦੀ ਹੈ ਉਹਦੇ ਬੇਸਿਸ 'ਤੇ ਅਸੀਂ ਇਨ੍ਹਾਂ ਦੇ ਚਾਰਜਿਜ਼ ਕਡੰਕਟ ਕਰਦੇ ਹਾਂ ਹਾਂਜੀ ਹਾਂਜੀ ਹਾਂਜੀ ਸਰ ਜ਼ਰੂਰ ਜ਼ਰੂਰ ਹਾਂਜੀ ਹਾਂਜੀ ਸਰ ਕਿਉਂਕਿ ਇੱਦਾਂ ਤਾਂ ਫੋਨ 'ਤੇ ਕਲੀਅਰ ਗੱਲ ਨਹੀਂ ਨਾ ਹੁੰਦੀ ਤੁਸੀਂ ਇੱਦਾਂ ਕਰਿਓ ਫੇਸ ਟੂ ਫੇਸ ਆ ਕੇ ਮਿਲ ਲਿਓ ਦੈਨ ਉਸ ਤੋਂ ਬਾਅਦ ਤੁਹਾਨੂੰ ਜੋ ਵੀ ਡਾਊਟਸ ਹੋਣਗੇ ਜੋ ਵੀ ਤੁਹਾਡੀ ਕੁਐਰੀਜ਼ ਹੋਏਗੀ ਅਸੀਂ ਤੁਹਾਡੀ ਕਲੀਅਰ ਕਰ ਦਾਂਗੇ ਠੀਕ ਹੈ ਸਰ ਹਾਂਜੀ ਸਰ ਓਕੇ ਸਰ ਓਕੇ ਥੈਂਕ ਯੂ ਸਰ